ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਬਲਵੀਰ ਸਿੰਘ ਮਾਨਸਾ ਤੋਂ ਬੋਲ ਰਿਹਾ ਹਾਂ ਮੈਂ ਪੰਜ ਦਿਨ ਪਹਿਲਾਂ ਤੁਹਾਡੀ ਗੱਡੀ ਕਿਰਾਏ 'ਤੇ ਬੁੱਕ ਕਰਕੇ ਦਿੱਲੀ ਗਿਆ ਸੀ ਅਤੇ ਮੈਨੂੰ ਤੁਹਾਡੀ ਗੱਡੀ ਅਤੇ ਡਰਾਈਵਰ ਬਹੁਤ ਪਸੰਦ ਆਏ ਉਹ ਹੁਣ ਮੈਂ ਕੁਝ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਪੰਦਰਾਂ ਜੂਨ ਤੱਕ ਦੁਬਾਰਾ ਦਿੱਲੀ ਲਿਜਾਉਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਉਹ ਹੀ ਗੱਡੀ ਅਤੇ ਡਰਾਈਵਰ ਉਪਲਬਧ ਕਰਵਾਉਣ ਦੀ ਖੇਚਲ ਕਰੋ ਤਾਂ ਜੋ ਮੈਂ ਉਹ ਹੀ ਗੱਡੀ ਅਤੇ ਡਰਾਈਵਰ ਨਾਲ ਦੁਬਾਰਾ ਦਿੱਲੀ ਜਾ ਸਕਾਂ ਅਤੇ ਤੁਰ ਫਿਰ ਕੇ ਆਨੰਦ ਮਾਣ ਸਕਾਂ ਬਹੁਤ ਬਹੁਤ ਧੰਨਵਾਦ